ਹੈਲੋ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਹੋ ਬਸ ਠੀਕ ਹੈ ਭੈਣ ਜੀ ਤੁਸੀਂ ਸੁਣਾਓ ਹੋਰ ਬਸ ਭੈਣ ਜੀ ਤੁਹਾਡੇ ਵੱਲ ਏ ਆਉਣ ਨੂੰ ਕਹਿੰਦੇ ਤੇ ਵੀ ਅੱਜ ਮੋਹਾਲੀ ਹਾਂਜੀ ਮੈਖਾ ਕੋਈ ਆਪਣਾ ਇੱਧਰ ਡਿਨਰ ਵਗੈਰਾ ਕਰਨ ਆਉਣਾ ਸੀ ਬਸ ਭੈਣ ਜੀ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਮਨ ਕਰ ਜਾਂਦਾ ਬਾਹਰ ਦਾ ਖਾਣੇ ਦਾ ਹਾਂਜੀ ਹਾਂਜੀ ਕੋਈ ਹੈਗਾ ਅੱਛਾ ਹੋਟਲ ਵਗੈਰਾ ਹਾਂਜੀ ਕੀ ਕਿਹੜਾ ਹੈ ਜੀ ਮੋਹਾਲੀ ਕੀ ਕੀ ਹੁੰਦਾ ਉੱਥੇ ਕੀ ਕੀ ਹੁੰਦਾ ਏ ਭੈਣਾਂ ਦੇ ਢਾਬੇ ਵਿੱਚ ਨਹੀਂ ਨਹੀਂ ਭੈਣ ਜੀ ਹੋਰ ਦੱਸੋ ਕੋਈ ਤੁਸੀਂ ਹਾਂ ਅੱਛਾ ਜੀ ਹੋਰ ਕੋਈ ਹਾਂਜੀ ਹਵੇਲੀ ਵਿੱਚ ਕੀ ਹੁੰਦਾ ਏ ਅੱਛਾ ਜੀ ਹਾਂਜੀ ਆਪਣਾ ਚਾਈਨਜ਼ ਵਗੈਰਾ ਵੀ ਹੰਦਾ ਏ ਹੈਂ ਜੀ ਹਾਂਜੀ ਛੋਲੇ ਭਟੂਰੇ ਵਗੈਰਾ ਕਿਹਦੇ ਕੋਲ ਹੁੰਦੇ ਹੈ ਜੀ ਅੱਛਾ ਜੀ ਫਿਰ ਭੈਣ ਜੀ ਆਈਏ ਜੀ ਅਸੀਂ ਅੱਜ ਦੇਖਦੇ ਹਾਂ ਭੈਣ ਜੀ ਫਿਰ ਅੱਜ ਤਾਂ ਆਉਣਾ ਤਾਂ ਹੈਗਾ ਏ ਠੀਕ ਹੈ ਭੈਣ ਜੀ ਅਸੀਂ ਆਉਂਦੇ ਜੀ ਫਿਰ ਛੋਲੇ ਭਟੂਰੇ ਉਹ ਖਾਂਦੇ ਹਾਂ ਹਾਂਜੀ ਹਾਂਜੀ ਤਿਆਰ ਰਹੋ ਤੁਸੀਂ ਵੀ ਅੱਛਾ ਜੀ ਤਿਆਰ ਰਹੋ ਭੈਣ ਜੀ ਚੰਗਾ ਜੀ ਫਿਰ ਹੈ ਨਾ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਓਕੇ ਜੀ ਓਕੇ ਓਕੇ ਭੈਣ ਜੀ ਓਕੇ ਓਕੇ